ਬੱਚਿਆਂ ਨੂੰ ਕਰਜੇ ਅਤੇ ਰਿਟਰਨ ਦੀ ਪ੍ਰਕਿਰਿਆ ਬਾਰੇ ਸਮਝਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਰਥਿਕ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਬੈਂਕ ਅਧਾਰੇ ਤੋਂ ਜਾ ਕੇ ਆਪਣਾ ਜੋ ਲੋਨ ਵਗੈਰਾ ਹੈ ਉਸਨੂੰ ਪਾਸ ਕਰਵਾ ਸਕਦੇ ਹਨ ਅਤੇ ਉਹਨਾਂ ਨੂੰ ਕਿਸੇ ਵੀ ਪ ਤਰ੍ਹਾਂ ਦੇ ਏਜੰਟ ਕੋਲ ਫਸਣ ਦਾ ਕੋਈ ਵੀ ਝੰਜਟ ਨਹੀਂ ਰਹੇਗਾ